ਮੈਂ ਸਵੇਰੇ ਮੋਰਨਿੰਗ ਪੰਜ ਵਜੇ ਉੱਠਦਾ ਹਾਂ ਸਭ ਨਾਲੋਂ ਪਹਿਲਾਂ ਬਰੱਸ਼ ਕਰਕੇ ਗਰਮ ਪਾਣੀ ਦਾ ਗਿਲਾਸ ਪੀ ਕੇ ਘਰ ਤੋਂ ਸ਼ੂਜ ਵਗੈਰਾ ਪਾ ਕੇ ਮੋਰਨਿੰਗ ਵਾਕ 'ਤੇ ਨਿਕਲ ਜਾਂਦਾ ਹਾਂ ਜੋ ਕਿ ਮੇਰੀ ਰੋ ਰੋਜ਼ਾਨਾ ਦੀ ਰੂਟੀਨ ਹੈ ਘੰਟਾ ਜਾਂ ਡੇਢ ਘੰਟੇ ਬਾਅਦ ਮੈਂ ਆ ਕੇ ਦੁਬਾਰਾ ਫਿਰ ਆਪਣੇ ਕੋਲਜ ਨੂੰ ਤਿਆਰ ਹੋ ਕੇ ਜਾਂਦਾ ਹਾਂ ਇਸੇ ਤਰ੍ਹਾਂ ਮੈਂ ਸ਼ਾਮ ਨੂੰ ਆ ਕੇ ਸ਼ਾਮ ਨੂੰ ਪੰਜ ਤੋਂ ਲੈ ਕੇ ਛੇ ਵਜੇ ਤੱਕ ਇੱਕ ਜਿੰਮ ਜਾਂਦਾ ਹਾਂ ਜੋ ਕਿ ਬਹੁਤ ਹੀ ਵਧੀਆ ਆਪਣੇ ਸਰੀਰ ਅਤੇ ਆਪਣੇ ਤਨ ਮਨ ਨੂੰ ਤੰਦਰੁਸਤ ਰੱਖਣ ਲਈ ਆਪਣੇ ਆਪ ਨੂੰ ਬੀਜ਼ੀ ਰੱਖਣ ਲਈ ਜਿੰਮ ਜਾਣਾ ਬਹੁਤ ਜ਼ਰੂਰੀ ਹੈ ਫਿਰ ਅੱਧਾ ਘੰਟਾ ਮੈਂ ਗਰਾਊਂਡ ਆ ਕੇ ਫੁੱਟਬਾਲ ਬੱਚਿਆਂ ਦੇ ਨਾਲ ਜਾਂ ਮੇਰੇ ਨਾਲ ਦੇ ਜਿਹੜੇ ਦੋਸਤ ਹੁੰਦੇ ਆ ਉਹਨਾਂ ਨਾਲ ਫੁੱਟਬਾਲ ਵੀ ਖੇਡਦਾ ਜਿਸ ਨਾਲ ਤੁਹਾਡੇ ਸਰੀਰ ਬਹੁਤ ਹੀ ਵਧੀਆ ਅਤੇ ਤੰਦਰੁਸਤ ਰਹਿੰਦਾ ਹੈ